ਜਿਵੇਂ ਕਿ ਪਿਛਲੇ ਸਾਲ ਗਣੇਸ਼ ਚਤੁਰਥੀ ਸੀ ਮੈਂ ਉਦੋਂ ਗਣੇਸ਼ ਜੀ ਦੀ ਮੂਰਤੀ ਆਪ ਬਣਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਜੋ ਬਜ਼ਾਰੋਂ ਮੂਰਤੀਆਂ ਮਿਲਦੀਆਂ ਹਨ ਉਹ ਪੀ ਓ ਪੀ ਨਾਲ ਬਣੀਆਂ ਹੁੰਦੀਆਂ ਹਨ ਅਤੇ ਕੈਮੀਕਲਸ ਦੇ ਜੋ ਕਲਰ ਹੁੰਦੇ ਹਨ ਉਹਨਾਂ ਨਾਲ ਉਹਨਾਂ ਨੂੰ ਕਲਰ ਕੀਤਾ ਜਾਂਦਾ ਹੈ ਜੋ ਕਿ ਚੌਦਾਂ ਦਿਨ ਬਾਅਦ ਨਦੀ ਵਿੱਚ ਨਦੀ ਵਿੱਚ ਮਿਲ ਜਾਣ 'ਤੇ ਨਦੀ ਨੂੰ ਬਹੁਤ ਜ਼ਿਆਦਾ ਹੀ ਪ੍ਰਦੂਸ਼ਿਤ ਕਰਦੀਆਂ ਹਨ ਮੈਂ ਇਹਨਾਂ ਗੱਲਾਂ ਤੋਂ ਹੀ ਪ੍ਰੇਰਨਾ ਲੈ ਕੇ ਮੈਂ ਖੁਦ ਇੱਕ ਚੰਗੀ ਮਿੱਟੀ ਲਈ ਅਤੇ ਉਸ ਤੋਂ ਗਣੇਸ਼ ਜੀ ਦੀ ਮੂਰਤੀ ਨੂੰ ਬਣਾਉਣਾ ਸਟਾਰਟ ਕੀਤਾ ਅਤੇ ਕੁਦਰਤੀ ਰੰਗਾਂ ਨਾਲ ਮੈਂ ਉਸ ਉਸਦੀ ਇੱਕ ਡੈਕੋਰੇਸ਼ਨ ਕੀਤੀ ਤਾਂ ਜੋ ਤਾਂ ਜੋ ਮਿ ਨਦੀਆਂ ਦਾ ਜੋ ਵੀ ਪਾਣੀ ਸੀ ਉਹ ਗੰਦਾ ਨਾ ਹੋ ਸਕੇ ਅਤੇ ਹੋ ਸਕੇ ਪਰ ਮੈਨੂੰ ਇਹਨਾਂ ਵਿੱਚ ਸ ਕੁਝ ਚੁਣੌਤੀਆਂ ਸੀ ਜਿਵੇਂ ਕਿ ਪੀ ਓ ਪੀ ਬਹੁਤ ਜਲਦੀ ਸੁੱਕ ਜਾਂਦੀ ਹੈ ਪਰ ਮਿੱਟੀ ਨੂੰ ਸੁੱਕਣ ਲਈ ਥੋੜ੍ਹਾ ਟਾਈਮ ਲੱਗਦਾ ਹੈ ਉਸ ਤੋਂ ਬਾਅਦ ਮੈਨੂੰ ਇੱਕ ਚੁਨੌਤੀ ਇਹ ਵੀ ਆਉਂਦੀ ਹੈ ਕਿ ਮੈਂ ਜਦੋਂ ਜਦੋਂ ਉਸਨੂੰ ਬਣਾ ਰਹੀ ਸੀ ਤਾਂ ਉਹ ਵਾਰ ਵਾਰ ਕਿਤੋਂ ਨਾ ਕਿਤੇ ਟੁੱਟ ਰਿਹਾ ਸੀ ਪਰ ਬਾਅਦ ਵਿੱਚ ਉਹ ਪੂਰੀ ਤਰ੍ਹਾਂ ਬਣ ਗਈ ਸੀ ਅਤੇ ਲੋਕ ਇਸ ਨਾਲ ਬਹੁਤ ਜ਼ਿਆਦਾ ਖੁਸ਼ ਵੀ ਹੋਏ